ਦਿਨੋਂ ਦਿਨ ਟੈਕਨੋਲੋਜੀ ਸਾਡੀ ਸਿਹਤਮੰਦ ਅਤੇ ਸਾਡੀ ਦੇਖਭਾਲ ਦੇ ਤਰੀਕਿਆਂ ਨੂੰ ਬਹੁਤ ਜ਼ਿਆ ਬਹੁਤ ਵਧੀਆ ਤਰੀਕਿਆਂ ਨਾਲ ਪ੍ਰਭਾਵਿਤ ਕਰ ਰਹੀ ਹੈ ਜਿਸ ਵਿੱਚ ਪਹਿਲਾਂ ਵਿਅਕਤੀ ਨੂੰ ਪਹਿਲਾਂ ਵਾਲੇ ਜ਼ਮਾਨੇ ਦੇ ਵਿੱਚ ਵਿਅਕਤੀ ਨੂੰ ਵਰਜਿਸ਼ ਕਰਨ ਜਾਂ ਕਸਰਤ ਕਰਨ ਲਈ ਬਾਹਰ ਜਾਣਾ ਪੈਂਦਾ ਸੀ ਜਿਵੇਂ ਜਿਵੇਂ ਟੈਕਨੋਲੋਜੀ ਨੇ ਵਾਧਾ ਕੀਤਾ ਹੈ ਇਸ ਤਰ੍ਹਾਂ ਵਿਅਕਤੀ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਫਾਇਦੇ ਵਿੱਚ ਹੋ ਚੁੱਕਿਆ ਹੈ ਜਿਸ ਦੇ ਵਿੱਚ ਉਹ ਯੂਟੀਊਬ ਵਗੈਰਾ ਤੋਂ ਦੇਖ ਕੇ ਆਪਣੀ ਦੇ ਸਿਹਤ ਦੀ ਦੇਖਭਾਲ ਕਰ ਸਕਦਾ ਹੈ ਉਸ ਤੋਂ ਤੋਂ ਯੂਟੀਊਬ ਤੋਂ ਨਵੇਂ ਨਵੇਂ ਤਰੀਕੇ ਲੱਭ ਸਕਦਾ ਹੈ ਟੈਕਨੋਲੋਜੀ ਦੀ ਵਰਤੋਂ ਕਰਕੇ ਅਸੀਂ ਅਸੀਂ ਜੋ ਕਿ ਕਸਰਤ ਵਾਲੀਆਂ ਮਸ਼ੀਨਾਂ ਹਨ ਉਸਨੂੰ ਘਰ ਮੰਗਵਾ ਸਕਦੇ ਹਾਂ ਇਸ ਨਾਲ ਟੈਕਨਾਲੋਜੀ ਸਾਡੀ ਸਿਹਤ ਅਤੇ ਸਿਹਤਮੰਦ ਅਤੇ ਦੇਖਭਾਲ ਕਰਨ ਦੇ ਤਰੀਕਿਆਂ ਨੂੰ ਬਦਲ ਰਹੀ ਹੈ ਟੈਕਨੋਲਜੀ ਸਾਡੇ ਲਈ ਬਹੁਤ ਵਧੀਆ ਚੀਜ਼ ਹੈ ਜਿਸ ਦੀ ਵਰਤੋਂ ਕਰਕੇ ਅਸੀਂ ਅਸੀਂ ਰੋਜ਼ਾਨਾ ਜੀਵਨ ਦੇ ਵਿੱਚ ਆਪਣੀ ਸਿਹ ਆਪਣੀ ਸਿਹਤ ਨੂੰ ਲੈ ਕੇ ਸਿਹਤ ਨੂੰ ਸੇਧਾਂ ਅਤੇ ਵਧੀਆ ਤਰੀਕੇ ਨਾਲ ਧਿਆਨ ਰੱਖ ਸਕਦੇ ਹਾਂ ਵਧੀਆ ਤਰੀਕੇ ਨਾਲ ਆਪਣਾ ਡਾਇਟ ਡਾਇਟ ਫਰੂਟ ਪਲਾਨ ਕਰ ਸਕਦੇ ਹਾਂ ਜੋ ਕਿ ਸਾਡੇ ਲਈ ਬਹੁਤ ਵਧੀਆ ਚੀਜ਼ ਹੈ ਟੈਕਨੋਲੋਜੀ ਦੇ ਆਉਣ ਨਾਲ ਸਾਈਕਲਿੰਗ ਵਗੈਰਾ ਅਸੀਂ ਘਰ ਬੈਠੇ ਹੀ ਕਰ ਸਕਦੇ ਹਾਂ ਅਤੇ ਕਰ ਸਕਦੇ ਹਾਂ ਜੋ ਕਿ ਸਾਨੂੰ ਕਸਰਤ ਲਈ